ਦਸ ਮਈ ਉੱਨੀ ਸੌ ਚੁਰਾਨਵੇਂ ਉਨੱਤੀ ਜੂਨ ਉੱਨੀ ਸੌ ਨੱਬੇ ਬਾਈ ਜਨਵਰੀ ਦੋ ਹਜ਼ਾਰ ਤੇਈ ਨੌਂ ਅਗਸਤ ਦੋ ਹਜ਼ਾਰ ਸੱਤ ਤੇਈ ਜੁਲਾਈ ਦੋ ਹਜ਼ਾਰ ਇੱਕ